ਹਸਪਤਾਲਾਂ ਵਿੱਚ ਰਸਾਇਣਿਕਾਂ ਦੀ ਵਿਸ਼ਾਲ ਸ਼੍ਰੇਣੀ ਅਤੇ ਸੈਂਟਰਾਂ ਦੀ ਭੀੜ ਜਿਸ ਵਿੱਚ ਉਹ ਉਹ ਹੁੰਦੀ ਹੈ ਉਹਨਾਂ ਨੂੰ ਨਿਰੰਤਰ ਲਈ ਇੱਕ ਯੋਜ ਬੱਧ ਯੋਜਨਾਬੱਧ ਪਹੁੰਚਾਂ ਦੀ ਮੰਗ ਕਰਦੇ ਹਨ ਐਕਸਪੋਜ ਅਤੇ ਉਹਨਾਂ ਦੇ ਨੁਕਸਾਨਦੇਹ ਨਤੀਜਿਆਂ ਦੀ ਰੋਕਥਾਮ ਲਈ ਰਸਾਇਣਿਕ ਦਰ ਰਸਾਇਣਿਕ ਪਹੁੰਚਾਉਣ ਲਈ ਦਾਇਰੇ ਦੀ ਸਮੱਸਿਆ ਨੂੰ ਸੰਭਾਲਣ ਲਈ ਬਹੁਤ ਮੁਸ਼ਕਲਾਂ ਹਨ ਇਸ ਇਸ ਤੋਂ ਇਲਾਵਾ ਜਿਵੇਂ ਕਿ ਸਿਹਤ ਦੇਖ ਵਿੱਚ ਉਹ ਰਸਾਇਣਿਕ ਖ਼ਤਰੇ ਅੱਧੀ ਸੰਖੇਪ ਜਾਣਕਾਰੀ ਵਿੱਚ ਨੋਟ ਹੈ ਹਸਪਤਾਲਾਂ ਦੇ ਵਾਤਾਵਰਨ ਵਿੱਚ ਬਹੁਤ ਸਾਰੇ ਰਸਾਇਣਿਕ ਧੱਮੇ ਢੁਕਵੇਂ ਅਧਿਆਏ ਕੀਤੇ ਗਏ ਹਨ ਨਵੇਂ ਰਸਾਇਣਿਕ ਲਗਾਤਾਰ ਪੇਸ਼ ਕੀਤੇ ਜਾ ਰਹੇ ਹਨ ਦੂਜਿਆਂ ਲਈ ਇੱਥੋਂ ਤੱਕ ਕਿ ਕੁਝ ਕਾਫ਼ੀ ਜਾਣੂ ਕੀਤੇ ਗਏ ਹਨ ਇਸ ਲਈ ਰਸਾਇਣਿਕ ਵਿਸ਼ੇਸ਼ ਦਿ ਦਿਸ਼ਾ ਨਿਰਦੇਸ਼ ਦੀ ਪਾਲਣਾ ਇੱਕ ਲਾਭਦਾਇਕ ਹੈ ਹਸਪਤਾਲਾਂ ਵਿੱਚ ਰਸਾਇਣਿਕ ਖ਼ਤਰੇ ਦਾ ਨਿਅੰਤਰ ਚੰਗੇ ਕਿੱਤੇ ਮੁੱਖ ਸਿਹਤ ਅਤੇ ਅਭਿਆਸ ਅਤੇ ਕਲਾਸਾਂ ਕਲਾਸਾਂ ਹਨ ਕਿਉਂਕਿ ਕਿਉਂਕਿ ਸਿਹਤ ਦੇਖ ਰੇਖ ਦੀਆਂ ਸਹੂਲਤਾਵਾਂ ਮਿਡਲ ਸਾਹਿਤ ਸਹਿਤ ਪਚਾਈਆਂ ਆਦਤਾਂ ਹੁੰਦੀਆਂ ਹਨ ਰੋਕਥਾਮ ਦੀ ਬਜਾਇ ਬਿਆਨਿਕ ਮਰੀਜ਼ਾਂ 'ਤੇ ਕੇਂਦਰਿਤ ਹੁੰਦੀਆਂ ਹਨ ਇਸ ਲਈ ਯਕੀਨ ਬਣਾਉਣਾ ਕਿ ਵਿਸ਼ੇਸ਼ ਦੀ ਲੋੜ ਹੈ ਸੈਨਿਕ ਨੂੰ ਸੰਭਾਲਣ ਲਈ ਸਥਿਤੀ ਅਸਲ ਵਿੱਚ ਰੋਕਥਾਮ ਹੈ ਇਹ ਉਪਾਅ ਮੁੱਖ ਤੌਰ 'ਤੇ ਕੇਂਦਰਿਤ ਹਨ ਕਰਮਚਾਰੀਆਂ ਦੀ ਬਜਾਇ ਕੰਮ ਵਾਲੀ ਥਾਂ 'ਤੇ